ਹਾਂਜੀ ਸਰ ਵਧੀਆ ਵਧੀਆ ਸਰ ਤੁਸੀਂ ਸੁਣਾਓ ਬਸ ਕੁਛ ਨਹੀਂ ਬੈਠੇ ਹੈ ਸਰ ਬਸ ਸਰ ਵਿਹਲੇ ਕਰਨਾ ਕੀ ਹੈ

ਕੀ ਕਰੇ ਜੀ ਪੰਜਾਬ 'ਚ ਬੇਰੁਜ਼ਗਾਰੀ ਇੰਨੀ ਹੋ ਰਹੀ ਹੈ ਜਿਹੜਾ ਵੀ ਹੈਗਾ ਸਾਰਾ ਬਾਹਰ ਹੀ ਤੁਰਿਆ ਹੋਇਆ ਐਕਚੁਲੀ ਪੰਜਾਬ 'ਚ ਕੋਈ ਇੰਡਸਟਰੀ ਡਿਵੈਲਪਮੈਂਟ ਹੈ ਨਹੀਂ ਹੋ ਰਹੀ ਨਾ ਕੋਈ ਬਾਹਰਲਾ ਬਿਜਨਸ ਬਾਹਰ 'ਚ ਪੰਜਾਬ 'ਚ ਆ ਨਹੀਂ ਰਿਹਾ ਹੈਗਾ

ਕੋਈ ਇੰਡਸਟਰੀ ਨਹੀਂ ਲੱਗ ਰਹੀ ਕੋਈ ਕੁਛ ਨਹੀਂ ਜੀ ਜਿਹੜੀ ਪੁਰਾਣੀ ਇੰਡਸਟਰੀ ਸੀ ਉਹ ਵੀ ਬੰਦ ਹੋ ਰਹੀਆਂ ਨੇ ਠੀਕ ਹੈ ਇੰਫਰਾਸਟਰਕਚਰ ਕੋਈ ਡਿਵੈਲਪ ਨਹੀਂ ਹੋ ਰਿਹਾ ਜਿਹਦੇ ਕਰਕੇ ਬੱਚੇ ਨੂੰ ਕੋਈ ਰੁਜ਼ਗਾਰ ਨਹੀਂ ਮਿਲ ਰਿਹਾ ਆਪਣਾ ਸਾਰਾ ਯੂਥ ਬਾਹਰ ਜਾ ਰਿਹਾ ਵਾ ਔਰ ਅੱਜ ਕੱਲ੍ਹ ਜਿਹੜੇ ਵੀ ਸਟੱਡੀ ਦੇ ਵੀ ਦੇਖੀਏ ਤਾਂ ਕੀ ਹੈ ਸਟਡੀ ਦੇ ਵੀ ਕੋਈ ਜਿੰਨਾ ਹੈ ਨਹੀਂ ਖ਼ਾਸ ਸਟੱਡੀ ਵਾਸਤੇ ਪੂਰਾ ਜੋਰ ਦੇਣਾ ਜਿਹੜਾ ਕੋਈ ਸਕਿੱਲਡ ਹੈ ਨਹੀਂ ਕੋਈ ਬੱਚਾ ਨਹੀਂ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਧਿਆਨ ਦੇਵੇ ਘੱਟੋ ਘੱਟ ਇਹ ਸਕਿੱਲਡ ਅਜੂਕੇਸ਼ਨ ਪ੍ਰੋਵਾਇਡ ਕਰੇ ਜਿਹਦੇ ਨਾਲ ਬੱਚੇ ਛੋਟੇ ਮੋਟੇ ਕੰਮ 'ਤੇ ਕਰ ਸਕਣ ਉਹਨਾਂ ਦਾ ਰੁਜ਼ਗਾਰ ਮਿਲ ਸਕੇ ਬਿਲਕੁਲ ਔਰ ਬਸ ਵਧੀਆ ਬੱਚਿਆਂ ਦਾ ਇਹ ਹੀ ਹੈ ਸਿਸਟਮ ਸਾਰਾ ਬਾਹਰ ਜਾਓ ਪੰਜਾਬ ਖਾਲੀ ਕੋਈ ਨਹੀਂ ਆ ਜਾਇਓ ਜਦੋਂ ਮਰਜੀ ਡਿਸਕਸ ਕਰਾਂਗੇ ਠੀਕ ਠੀਕ ਓਕੇ